ਹੈਲੋ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਓਕੇ ਓਕੇ ਬੋਂਜੌਰ ਤੋਂ ਆਏ ਹੋ ਜੀ ਠੀਕ ਹੈ ਜੀ ਹਾਂਜੀ ਹਾਂਜੀ ਕਿਹੜੇ ਬੈਂਕ ਸਰ ਤੁਸੀਂ ਜੋਬ ਕਰਦੇ ਹੋ ਠੀਕ ਹੈ ਸਰ ਅਤੇ ਤੁਸੀਂ ਕਿਹੜੇ ਕਿਹੜੇ ਸ਼ਹਿਰ ਤੁਹਾਨੂੰ ਭੇਜਦੇ ਪਏ ਆ ਕਿਆ ਤੁਹਾਡੀ ਚੋਆਇਸ ਆ ਕੋਈ ਉਹ 'ਚ ਮੈਂ ਕਿਹਾ ਕਿਹੜੇ ਸ਼ਹਿਰ ਦੇ ਆਸ ਪਾਸ ਤੁਸੀਂ ਰਹਿਣਾ ਪਸੰਦ ਕਰਦੇ ਹੋ ਪਰ ਕਰੋਗੇ ਹਾਂਜੀ ਅੰਮ੍ਰਿਤਸਰ ਲਾਗੇ ਠੀਕ ਹੈ ਸਰ ਤ ਅਤੇ ਅੰਮ੍ਰਿਤਸਰ 'ਚ ਬੈਂਕ ਦੀ ਜੋਬ ਤੁਹਾਨੂੰ ਮਿਲੀ ਠੀਕ ਹੈ ਅਤੇ ਨ ਅੰਮ੍ਰਿਤਸਰ ਠੀਕ ਹੈ ਸਰ ਇੱਥੇ ਬੜਾ ਵਧੀਆ ਸ਼ਹਿਰ ਹੈ ਜੀ ਇੱਥੇ ਤੁਸੀਂ ਗੋਲਡਨ ਟੈਂਪਲ ਆ ਤੁਸੀਂ ਇੱਥੇ ਖਾਸ ਤੌਰ 'ਤੇ ਹਰ ਐਤਵਾਰ ਦੀ ਐਤਵਾਰ ਮੱਥਾ ਟੇਕਣ ਅੰਮ੍ਰਿਤਸਰ ਦੇ ਕੋਲ ਵਾਹਗਾ ਬੋਡਰ ਹੈ ਜੀ ਉੱਥੇ ਤੁਸੀਂ ਜਾ ਸਕਦੇ ਹੋ ਸ਼ਾਮ ਵੇਲੇ ਅਤੇ ਬਾਕੀ ਹੋਰ ਵੀ ਕਈ ਚੀਜ਼ਾਂ ਦੁਰਗਿਆਣਾ ਮੰਦਰ ਹੈ ਇੱਥੇ ਬੜਾ ਵਧੀਆ ਉੱਥੇ ਤੁਸੀਂ ਜਾ ਸਕਦੇ ਹੋ ਬਾਕੀ ਤਾਂ ਇੰਟਰਸਟ ਕੀ ਕੀ ਬਿਜ਼ਨਸ ਵਗੈਰਾ ਵੀ ਕਰਨਾ ਚਾਹੁੰਦੇ ਨਾਲ ਜੋਬ ਦੇ ਹਾਂਜੀ ਕਿਹੜਾ ਬਿਜ਼ਨਸ ਕਰਨਾ ਚਾਹੁੰਦੇ ਹੋ ਕੋਈ ਗੱਲ ਨਹੀਂ ਸਰ ਤੁਸੀਂ ਅੰਮ੍ਰਿਤਸਰ 'ਚ ਕਰ ਲਉ ਇੱਥੇ ਕਾਫੀ ਵਪਾਰੀ ਕੱਪੜੇ ਦੇ ਵਪਾਰੀ ਬਥੇਰੇ ਨੇ ਇੱਥੇ ਅੰਮ੍ਰਿਤਸਰ 'ਚ ਕੱਪੜੇ ਦਾ ਕੰਮ ਕਰਦੇ ਉਹਨਾਂ ਨੂੰ ਲੋਨ ਵਗੈਰਾ ਦੀ ਜ਼ਰੂਰਤ ਵਗੈਰਾ ਪੈਂਦੀ ਰਹਿੰਦੀ ਹੈ ਅਤੇ ਤੁਸੀਂ ਓਹ ਉਹਨਾਂ ਨੂੰ ਮੈਂ ਨੰਬਰ ਤੁਹਾਨੂੰ ਦੇ ਦਾਂਗਾ ਮੇਰੇ ਕਈ ਨੌਨ 'ਚ ਵੀ ਨੇ ਕਈ ਦੋਸਤ ਯਾਰ ਮੇਰੇ ਅਤੇ ਤੁਹਾਨੂੰ ਹੈਲਪ ਹੋ ਜਾਏਗੀ ਉਸ ਚੀਜ਼ ਤੋਂ ਅਤੇ ਬਾਕੀ ਤੁਸੀਂ ਜੇ ਚਾਹੋ ਤਾਂ ਹੋਰ ਵੀ ਕਿਸੇ ਸਿਟੀ 'ਚ ਪ੍ਰੈਫਰ ਕਰ ਸਕਦੇ ਜੇ ਸਪੋਰਟਸ ਦਾ ਕੰਮ ਕਰਨਾ ਅਤੇ ਜਲੰਧਰ ਜਾ ਸਕਦੇ ਹੋ ਅਤੇ ਵੂਲਣ ਦਾ ਕੰਮ ਕਰਨਾ ਅਤੇ ਲੁਧਿਆਣੇ ਵੀ ਜਾ ਸਕਦੇ ਹੋ ਅਤੇ ਬਾਕੀ ਜਿਹੜੇ ਇੱਕ ਆਪਣਾ ਮੇਨ ਤਿੰਨ ਸਿਟੀਜ਼ ਹੀ ਆ ਪੰਜਾਬ ਦੇ ਵਿੱਚ ਬਠਿੰਡਾ ਵਗੈਰਾ ਫਿਰੋਜ਼ਪੁਰ ਵਗੈਰਾ ਥੋੜ੍ਹਾ ਜਿਹਾ ਪਰੇ ਪੈ ਜਾਂਦੇ ਨੇ ਮੇਨ ਤਿੰਨ ਸਿਟੀਜ਼ ਹੀ ਪੈ ਜਾਂਦੀਆਂ ਨਾਲ ਚੰਡੀਗੜ੍ਹ ਵੀ ਆਸ ਪਾਸ ਪੈ ਜਾਂਦਾ ਜਲੰਧਰ ਦੇ ਤੁਸੀਂ ਚੰਡੀਗੜ੍ਹ ਵੀ ਆ ਸਕਦੇ ਹੋ ਫਗਵਾੜਾ ਹਾਂਜੀ ਚੰਡੀਗੜ੍ਹ ਕਾਫੀ ਫੇਮਸ ਹੈ ਲੋਕ ਵੀਕੈਂਡ ਦੇ ਵੀਕੈਂਡ ਜਾਂਦੇ ਨੇ ਅਤੇ ਅਤੇ ਤੁਹਾਡਾ ਵੈਸੇ ਮੇਨ ਇੰਟਰੇਸਟ ਕਿ ਕਿਹੜੇ ਸ਼ਹਿਰ ਜਾਣ ਦਾ ਹਾਂ ਚਲੋ ਕੋਈ ਨਹੀਂ ਤੁਸੀਂ ਆ ਜਾਓ ਜਦੋਂ ਵੀ ਆਓਗੇ ਮੈਨੂੰ ਫ਼ੋਨ ਕਰ ਲੈਣਾ ਮੈਂ ਹਾਂ ਅੰਮ੍ਰਿਤਸਰ 'ਚ ਤੁਸੀਂ ਆਓ ਅਤੇ ਤੁਹਾਨੂੰ ਮੈਂ ਕੋਈ ਨਹੀਂ ਕੋਂਟੈਕਟ ਦੇ ਦਾਂਗਾ ਅਤੇ ਤੁਹਾਨੂੰ ਦਿੱਕਤ ਨਹੀਂ ਆਏਗੀ ਕਿਸੇ ਚੀਜ਼ ਦੀ ਹੋਰ ਕੋਈ ਸੇਵਾ ਹੈ ਦੱਸਿਓ ਸਰ ਖਾਣ ਪੀਣ ਦਾ ਸਰ ਇੱਥੇ ਭਰਾਵਾਂ ਢਾਬਾ ਜਾਓ ਜੋ ਮਰਜ਼ੀ ਜਿੱਥੇ ਮਰਜ਼ੀ ਜਾਓ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਚਲੋ ਸ਼ੋਪਿੰਗ ਵਗੈਰਾ ਸ਼ੋਪਿੰਗ ਵੀ ਕਾਫ਼ੀ ਇੱਥੇ ਵਧੀਆ ਵਧੀਆ ਮੋਲਜ਼ ਨੇ ਅਲਫ਼ਾ ਮੋਲ ਖੁੱਲ੍ਹ ਗਿਆ ਜੀ ਕਾਫ਼ੀ ਨੇ ਚਲੋ ਤੁਸੀਂ ਆ ਜਾਓ ਮੈਂ ਤੁਹਾਨੂੰ ਜਦੋਂ ਮਿਲੋਗੇ ਤੁਹਾਨੂੰ ਪਰਸਨਲੀ ਮਿਲਾਂਗਾ ਆ ਕੇ ਤੁਸੀਂ ਦੱਸਿਓ ਜਦੋਂ ਆਉਣਾ ਹੋਏਗਾ ਅਤੇ ਠੀਕ ਹੈ ਜੀ ਓਕੇ ਜੀ ਓਕੇ ਜਨਾਬ ਥੈਂਕ ਯੂ ਜੀ